ਬਚਪਨ ਦੀਆਂ ਮਨਪਸੰਦ ਯਾਦਾਂ ਜਾਂ ਸਾਨੂੰ ਆਪਣਾ ਪਾਗਲਪਨ ਕਹਿ ਲਈਏ ਮੈਂ ਸ਼ਾਇਦ ਬਾਰਾਂ ਜਾਂ ਤੇਰਾਂ ਸਾਲ ਦਾ ਸੀ ਮੇਰਾ ਵੱਡਾ ਭਰਾ ਜਿਹੜਾ ਜੀ ਬੜਾ ਸ਼ਰਾਰਤੀ ਹੁੰਦਾ ਸੀ ਇੱਕ ਵਾਰ ਖੇਡਦੇ ਹੋਏ ਛੱਤ ਤੋਂ ਡਿੱਕ ਡਿੱਗ ਗਿਆ ਫਿਰ ਉਹ ਆਪਣੀ ਲੱਤ ਨੂੰ ਪਲਸਤਰ ਕਰਵਾ ਕੇ ਉਸ ਨੂੰ ਤੋੜ ਕੇ ਬੈਠ ਗਿਆ ਉਹਨਾਂ ਦੀ ਮਹਿਮਾਨ ਨਿਵਾਜੀ ਨਾਲ ਪੂਰਾ ਮਹੀਨਾ ਲੱਗੀ ਰਹੀ ਐਵੇਂ ਮੰਨੋ ਕਿ ਜਿਵੇਂ ਕੋਈ ਰਾਜਾ ਜਾਂ ਮਹਾਰਾਜਾ ਸਾਡੇ ਘਰ ਆਏ ਹੋਣ ਹਰ ਦੋ ਦਿਨ ਬਾਅਦ ਅਧਿਆਪਕ ਸਕੂਲ ਤੋਂ ਆ ਕੇ ਉਸ ਨੂੰ ਪੜ੍ਹਾਉਂਦਾ ਸੀ ਤਾਂ ਜੋ ਉਹ ਜਮਾਤ ਵਿੱਚ ਪਿੱਛੇ ਨਾ ਰਹਿ ਜਾਵੇ ਹਰ ਰੋਜ਼ ਉਸ ਦੇ ਦੋਸਤ ਆ ਕੇ ਗੱਲਾਂ ਕਰਦੇ ਸਾਡੀ ਮਾਂ ਉਸ ਨੂੰ ਗਰਮ ਨਾਸਤਾ ਪਰੋਸਦੀ ਮਹਿਮਾਨਾਂ ਦੀ ਆਮਦ ਲੱਗੀ ਰਹਿੰਦੀ ਸੀ ਮੈਂ ਮਨ ਹੀ ਮਨ ਸੋਚਦਾ ਸੀ ਵਾਹ ਭਈ ਕੀ ਮਜਾ ਹੈ ਅਤੇ ਮੈਂ ਉਸੇ ਪਲ ਫੈਸਲਾ ਕੀਤਾ ਕਿ ਮੈਂ ਵੀ ਅਜਿਹਾ ਕਾਰਨਾਮਾ ਕਰਨਾ ਹੈ ਇੱਕ ਵਾਰ ਮੈਂ ਝੂਲਾ ਝੂਲ ਰਿਹਾ ਸੀ ਅਤੇ ਅਚਾਨਕ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਜੇ ਮੈਂ ਸਵਿੰਗ ਨੂੰ ਬਹੁਤ ਸਖ਼ਤ ਸਵਿੰਗ ਕਰਦਾ ਹਾਂ ਤਾਂ ਹੋ ਸਕਦਾ ਹੈ ਕਿ ਮੇਰਾ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਾਂ ਅਤੇ ਮੇਰੀ ਬਾਂਹ ਟੁੱਟ ਸਕਦੀ ਹੈ ਮੇਰਾ ਭਰਾ ਮੇਰੇ ਚਾਚੇ ਦਾ ਮੁੰਡਾ ਉੱਥੇ ਹੀ ਖੜ੍ਹਾ ਸੀ ਇਸ ਲਈ ਮੈਂ ਉਸ ਨੂੰ ਹੋਰ ਜੋਰ ਨਾਲ ਝੂਲਣ ਲਈ ਕਿਹਾ ਉਹ ਝੂਲ ਰਿਹਾ ਸੀ ਅਤੇ ਮੈਂ ਹੋਰ ਹੋਰ ਹੋਰ ਹੋਰ ਦੇ ਨਾਅਰੇ ਲਾਉਂਦਾ ਹੋਇਆ ਝੂਲ ਰਿਹਾ ਸੀ ਆਖਿਰਕਾਰ ਮੇਰਾ ਹੱਥ ਜੋਰ ਨਾਲ ਦਬਾਇਆ ਗਿਆ ਅਤੇ ਮੈਂ ਇੱਕ ਝਟਕੇ ਨਾਲ ਡਿੱਗ ਪਿਆ ਫਿਰ ਕੀ ਸੀ ਮੈਂ ਵੀ ਉਸ 'ਤੇ ਡਿੱਗ ਪਿਆ ਮੇਰਾ ਗਰੀਬ ਭਰਾ ਆਹ ਉਸ ਦੀ ਲੱਤ ਟੁੱਟ ਗਈ ਅੱਜ ਵੀ ਜਦੋਂ ਭੈਣ ਭਰਾ ਮਿਲਦੇ ਹਨ ਤਾਂ ਪਹਿਲਾਂ ਹੀ ਪੁੱਛ ਲੈਂਦੇ ਹਨ ਭਰਾ ਜੀ ਦੱਸੋ ਹੁਣ ਤੱਕ ਉਹ ਕਿਹੜਾ ਪਾਗਲ ਸੀ ਤਾਂ ਜੋ ਮੈਂ ਆਪਣੀ ਜਾਨ ਬਚਾ ਸਕਾਂ